ਹਾਂਜੀ ਸਾਡੀ ਜਿਹੜੀ ਬਿਜਲੀ ਰੋਜ਼ੀ ਰੋਟੀ ਹੈਗੀ ਉਹ ਬਿਜਲੀ 'ਤੇ ਨਿਰਭਰ ਕਰਦੀ ਆ ਅੱਜ ਕੱਲ੍ਹ ਦੇ ਯੁੱਗ ਵਿੱਚ ਕੁਛ ਵੀ ਬਣਾਉਣ ਲਈ ਓਵਨ ਮਾਈਕਰੋਵੇਵ ਇਹ ਵਗੈਰਾ ਯੂਜ ਹੁੰਦੇ ਹਨ ਮੇਨਲੀ ਲਾਈਟ ਯੂਜ ਹੁੰਦੀ ਹੈ ਅਤੇ ਲਾਈਟ ਹੋਵੇਗੀ ਤਾਂ ਆਪਾਂ ਕੁਛ ਚੀਜ਼ ਬਣਾ ਸਕਦੇ ਹਾਂ ਅਤੇ ਜੇ ਜਿੱਦਾਂ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗਦੇ ਆ ਅਤੇ ਉਹ ਸਾਡੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਬਿਜਲੀ ਦੇ ਕੱਟ ਵਿੱਚ ਰੋਸ਼ਨੀ ਲਈ ਸਾਡੇ ਕੋਲ ਕਾਫ਼ੀ ਵਿਕਲਪ ਹਨ ਆਪਾਂ ਟੋਰਚ ਵੀ ਜਗਾ ਸਕਦੇ ਹਾਂ ਆਪਾਂ ਮੋਮਬੱਤੀਆਂ ਵੀ ਜਗਾ ਸਕਦੇ ਹਾਂ ਅਤੇ ਲੋਕਾਂ ਹੁਣ ਜੋ ਕਿ ਮੇਨਲੀ ਹੁਣ ਜੋ ਕਿ ਫੇਮਸ ਹੋ ਗਿਆ ਜੋ ਕਿ ਹਰ ਇੱਕ ਘਰ ਵਿੱਚ ਮਿਲਦਾ ਉਹ ਹੈ ਇਨਵਰਟਰ ਇਨਵਰਟਰ ਦੇ ਆਉਣ ਨਾਲ ਸਾਨੂੰ ਕੋਈ ਤੰਗੀ ਨਹੀਂ ਹੁੰਦੀ ਜਿਸ ਤਰ੍ਹਾਂ ਹੀ ਲਾਈਟ ਜਾਂਦੀ ਹੈ ਤਾਂ ਇਨਵਰਟਰ ਨਾਲ ਸਾਨੂੰ ਲਾਈਟਸ ਦੁਬਾਰਾ ਜੱਗ ਜਾਂਦੀਆਂ ਜੋ ਕਿ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਬਿਜਲੀ ਦੇ ਕੋਈ ਕੱਟ ਲੱਗਿਆ ਹਾਂ ਇਹ ਹੋ ਸਕਦਾ ਹੈ ਕਿ ਜੇ ਬਿਜਲੀ ਦਾ ਕੱਟ ਬਹੁਤ ਜ਼ਿਆਦਾ ਟਾਈਮ ਲਈ ਲੱਗੇ ਵੈਸੇ ਚੌਵੀ ਘੰਟਿਆਂ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਅਤੇ ਜਿਵੇਂ ਬਿਜਲੀ ਦਾ ਕੱਟ ਬਹੁਤ ਜ਼ਿਆਦਾ ਟਾਈਮ ਤੱਕ ਲੱਗਦਾ ਅਤੇ ਫਿਰ ਬੈਟਰੀਆਂ ਵੀ ਡਾਊਨ ਹੋ ਜਾਂਦੀ ਹੈ ਜੋ ਕਿ ਸਾਡੇ ਕੰਮ ਕਰਨ ਦੇ ਵਿੱਚ ਬਹੁਤ ਇਫੈਕਟ ਕਰਦੀ ਹੈ ਬਿਜਲੀ ਤੋਂ ਬਿਨਾਂ ਕੰਮ ਕਰਨਾ ਬਹੁਤ ਔਖਾ ਹੈ ਉਹ ਚਾਹੇ ਸਾਡੀ ਰੋਟੀ ਬਣਾਉਣ 'ਚ ਹੋਵੇ ਰੋਜ਼ੀ ਰੋਟੀ ਕਮਾਉਣ 'ਚ ਹੋਵੇ ਕਿਤੇ ਆਉਣ ਜਾਣ 'ਚ ਹੋਵੇ ਜਾਂ ਸਾਡੇ ਕੰਮਾਂ ਕਾਰਾਂ 'ਤੇ ਜਾਣਾ ਹੋਵੇ ਹਰ ਕੋਈ ਬਿਜਲੀ ਨਾਲ ਕਨੈਕਟਿਡ ਹੁੰਦਾ ਹੈ ਅਤੇ ਹਰ ਕੋਈ ਕੋਈ ਸਾਡਾ ਕੰਪਿਊਟਰ ਚਲਾਉਣਾ ਹੋਵੇ ਜੇ ਬਿਜਲੀ ਨਹੀਂ ਹੈ ਤਾਂ ਸਾਡੇ ਸਾਰੇ ਕੰਮ ਠੱਪ ਹੋ ਜਾਣਗੇ ਅਤੇ ਸਾਡੀ ਰੋਟੀ ਰੋਟੀ ਕਮਾਉਣੀ ਬਹੁਤ ਔਖੀ ਹੋ ਜਾਵੇਗੀ ਅਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ